ਹੈਲੋ ਕੀ ਤੁਸੀਂ ਹੰਗਰੀ ਪੁਆਇੰਟ ਤੋਂ ਗੱਲ ਕਰ ਰਹੇ ਹੋ ਮੈਂ ਹਰਮਨ ਕੌਰ ਤੁਹਾਨੂੰ ਸਵੇਰੇ ਕਾਲ ਕਰਕੇ ਇੱਕ ਆਰਡਰ ਪਲੇਸ ਕੀਤਾ ਸੀ ਅਤੇ ਕੁਝ ਕਾਰਨਾਂ ਕਾਰਨ ਮੈਨੂੰ ਸ਼ਹਿਰ ਤੋਂ ਬਾਹਰ ਜਾਣਾ ਪੈ ਰਿਹਾ ਹੈ ਜਿਸ ਕਰਕੇ ਮੈਂ ਉਹ ਆਰਡਰ ਰਿਸੀਵ ਨਹੀਂ ਕਰ ਪਾਵਾਂਗੀ ਉਸ ਆਰਡਰ ਦੇ ਲਈ ਬਣਦੀ ਰਕਮ ਮੈਂ ਤੁਹਾਨੂੰ ਐਡਵਾਂਸ ਹੀ ਯੂ ਪੀ ਆਈ ਪੇਮੈਂਟ ਦੇ ਦੁਆਰਾ